ਵੈਸੇ ਤਾਂ ਮੈਨੂੰ ਘੁੰਮਣ ਫਿਰਨ ਦਾ ਬਹੁਤ ਜ਼ਿਆਦਾ ਸ਼ੌਕ ਹੈਗਾ ਹੈ ਮੈਂ ਅਕਸਰ ਹੀ ਮੈਨੂੰ ਨਵੀਆਂ ਨਵੀਆਂ ਜਗ੍ਹਾ 'ਤੇ ਜਾਣਾ ਅਤੇ ਨਵੇਂ ਨਵੇਂ ਦੋਸਤ ਬਣਾਉਣਾ ਜਿਹੜੇ ਮਤਲਬ ਮੈਨੂੰ ਵਧੀਆ ਗਾਈਡ ਕਰ ਸਕਣ ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਇਸ ਕਰਕੇ ਮੈਂ ਨਵੀਂ ਨਵੀਂ ਜਗ੍ਹਾ 'ਤੇ ਜਾਂਦਾ ਰਹਿੰਦਾ ਹੈਗਾ ਤਾਂ ਜੋ ਇੱਕ ਤਾਂ ਉਹਨਾਂ ਦਾ ਸਾਨੂੰ ਕਲਚਰ ਵਗੈਰਾ ਸਿੱਖਣ ਨੂੰ ਮਿਲਦਾ ਹੈਗਾ ਹੈ ਹੈਂ ਉਹਨਾਂ ਤੋਂ ਸਾਨੂੰ ਹੋਰ ਵੀ ਚੀਜ਼ਾਂ ਬਹੁਤ ਵਧੀਆ ਸਿੱਖਣ ਨੂੰ ਮਿਲਦੀਆਂ ਕਿਉਂਕਿ ਜੇ ਬੰਦਾ ਆਪਣੇ ਇਲਾਕੇ ਤੋਂ ਬਾਹਰ ਜਾਂਦਾ ਹੈਗਾ ਅਤੇ ਉੱਥੋਂ ਦਾ ਜਿਹੜਾ ਸਾਨੂੰ ਹੈਗਾ ਇਮਵਾਇਰਮੈਂਟ ਵਗੈਰਾ ਤੋਂ ਅਤੇ ਨੇਚਰ ਵਗੈਰਾ ਤੋਂ ਅਤੇ ਉੱਥੇ ਦੇ ਜਿਹੜੇ ਪਰਸਨਸ ਤੋਂ ਹੁੰਦੇ ਹੈਗੇ ਹੈ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈਗਾ ਹੈ ਇਸ ਕਰਕੇ ਮੈਂ ਘੁੰਮਣਾ ਫਿਰਨਾ ਬਹੁਤ ਜ਼ਿਆਦਾ ਪ੍ਰੈਫਰ ਕਰਦਾ ਰਹਿੰਦਾ ਹੈਗਾ ਹੈ ਹੈਂ ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਹੈ ਜਿੱਦਾਂ ਹੁਣ ਮੈਂ ਪਿਛਲੇ ਸਾਲ ਹੇਮਕੁੰਟ ਸਾਹਿਬ ਗਿਆ ਸੀਗਾ ਅਤੇ ਉੱਥੇ ਜਿਹੜਾ ਜਿੱਦਾਂ ਹੁਣ ਪਹਿਲਾਂ ਚੜ੍ਹਨ ਤੋਂ ਮੈਨੂੰ ਤਾਂ ਡਰ ਲੱਗਦਾ ਸੀਗਾ ਅਤੇ ਮੇਰੇ ਦੋਸਤਾਂ ਨੇ ਜਿਹੜਾ ਹੈਗਾ ਮੈਨੂੰ ਹੱਲਾਸ਼ੇਰੀ ਦਿੱਤੀ ਵੀ ਕੋਈ ਗੱਲ ਨਹੀਂ ਵੀ ਪਹਾੜ ਵਗੈਰਾ 'ਤੇ ਅਸੀਂ ਵੀ ਤੇਰੇ ਨਾਲ ਹੀ ਹੈਗੇ ਜਾਂ ਕੋਈ ਦੇਖ ਲਉਂਗੇ ਜੋ ਕੁਛ ਵੀ ਹੋਇਆ ਹੈਗਾ ਹੈ ਹੈਂ ਤਾਂ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਪੰਪ ਛਕਾਏ ਮੈਨੂੰ ਪੂਰੇ ਉਹਨੇ ਫਿਰ ਉਹਦੇ ਕਰਕੇ ਜਿਹੜਾ ਹੈਗਾ ਮੈਂ ਉੱਥੇ ਜਾ ਸਕਿਆ ਤਾਂ ਇਹਦੇ ਨਾਲ ਜਿਹੜਾ ਹੋਇਆ ਕਿਆ ਹੈਗਾ ਹੈ ਜਿੱਦਾਂ ਹੁਣ ਜਿਹੜੇ ਮੇਰੇ ਦਿਮਾਗ 'ਚ ਜਾਂ ਮੇਰੇ ਮਨ 'ਚ ਜਿਹੜਾ ਇੱਕ ਕੀੜਾ ਬੈਠਾ ਹੁੰਦਾ ਤਾ ਮੇ ਇੱਕ ਡਰ ਬੈਠਾ ਹੁੰਦਾ ਤਾ ਬਈ ਮੈਂ ਉੱਪਰ ਚੜ੍ਹ ਨਹੀਂ ਸਕਦਾ ਹੈਗਾ ਮੈਂ ਇਹ ਕੰਮ ਕਰ ਨਹੀਂ ਸਕਦਾ ਹੈਗਾ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਮੇਰੇ ਦੋਸਤਾਂ ਨੇ ਕੰਮ ਪੰਪ ਛਕਾਉਣ ਨਾਲ ਹੱਲਾਸ਼ੇਰੀ ਦੇਣ ਨਾਲ ਮੈਨੂੰ ਇੰਨਾ ਕੁ ਬੈਨੀਫਿਟ ਮਿਲਿਆ ਜੇ ਹੁਣ ਕਿਤੇ ਮੈਨੂੰ ਹੋਰ ਕਿਤੇ ਚੜ੍ਹਾਈ 'ਤੇ ਭਲਾ ਉਹਦੇ ਨਾਲੋਂ ਜ਼ਿਆਦਾ ਵੀ ਚੜ੍ਹਾਈ 'ਤੇ ਮੈਨੂੰ ਭਲਾ ਮਾਊਂਟ ਐਵਰੈਸਟ ਪਰ ਚੜ੍ਹਨ ਨੂੰ ਇਕੱਲੇ ਨੂੰ ਭੇਜ ਦਿਉ ਤਾਂ ਮੈਂ ਉੱਥੋਂ ਵੀ ਜਾ ਕੇ ਚੜ੍ਹ ਜੂੰਗਾ ਮਤਲਬ ਇੱਦਾਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਹੈਗਾ ਹੈ ਅਤੇ ਇਸ ਤਰ੍ਹਾਂ ਮੈਂ ਦੇਖਿਆ ਜਾ ਸਕਦਾ ਹੁਣ ਮੈਨੂੰ ਮਤਲਬ ਕੋਈ ਵੀ ਜਿਹੜੀ ਉੱਚੀ ਜਗ੍ਹਾ 'ਤੇ ਜੇ ਪਹਾੜੀ ਜਾਂ ਚਟਾਨ 'ਤੇ ਚੜ੍ਹਨ 'ਤੇ ਮੈਨੂੰ ਕੋਈ ਵੀ ਡਰ ਨਹੀਂ ਲੱਗਦਾ ਹੈਗਾ ਹੈ